ਮੇਰਾ ਨਾਮ ਭਗਤ ਸਿੰਘ ਹੈ ਮੈਂ ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਸਟੇਟ ਬੈਂਕ ਆਫ ਪਟਿਆਲਾ ਤੋਂ ਬੋਲ ਰਹੇ ਹੋ ਮੈਂ ਆਪਣਾ ਬਿੱਲ ਲੀਡਲਾਈਨ 'ਤੇ ਭਰ ਦਿੱਤਾ ਸੀ ਪਰ ਮੇਰੇ ਕੋਲ ਨਾ ਕੋਈ ਬਿੱਲ ਦੀ ਰਸੀਦ ਹੈ ਨਾ ਕੋਈ ਹੋਰ ਯਕੀਨ ਦਵਾਉਣ ਵਾਲੀ ਗੱਲ ਹੈ ਇਸ ਲਈ ਤੁਸੀਂ ਮੈਨੂੰ ਇਸ ਬਾਰੇ ਜਾਣਕਾਰੀ ਦਿਓ ਵੇ ਅਤੇ ਮੇਰੀ ਮਦਦ ਕਰੋ ਤਾਂ ਕਿ ਮੈਨੂੰ ਪਤਾ ਲੱਗ ਜਾਵੇ ਕਿ ਮੇਰਾ ਬਿੱਲ ਭਰਿਆ ਗਿਆ ਹੈ ਜ ਜਾਂ ਕੋਈ ਹੋਰ ਲੈਣ ਹੈ ਜੇ ਮੈਂ ਕਿਤੇ ਬਾਹਰ ਜਾਣਾ ਹੋਵੇ ਜਾਂ ਕੋਈ ਹੋਰ ਸਕੀਮ ਕਰਨੀ ਹੋਵੇ ਉਸ ਵਿੱਚ ਅੜਿੱਕਾ ਨਾ ਬਣੇ ਅਤੇ ਮੈਨੂੰ ਨੋਟਿਸ ਆਉਂਦੇ ਫਿਰਨ ਇਸ ਲਈ ਮੈਂ ਤੁਹਾਡੀ ਮਦਦ ਚਾਹੁੰਦਾ ਹਾਂ ਕਿਰਪਾ ਕਰਕੇ ਮੇਰੀ ਮਦਦ ਕਰੋ ਅਤੇ ਮੈਨੂੰ ਇਸ ਬਾਰੇ ਸਾਰੀ ਜਾਣਕਾਰੀ ਦਿਓ ਜੇ ਕੋਈ ਇਸ ਵਿੱਚ ਅੜਿੱਕਾ ਬਣ ਲਈ ਅ ਵਾਲੀ ਗੱਲ ਹੈ ਅੜਿੱਕਾ ਬਣ ਜਾਵੇ ਉਸ ਬਾਰੇ ਤੋਂ ਪਹਿਲਾਂ ਹੀ ਕਲੀਅਰ ਹੋ ਜਾਵੇ ਇਸ ਲਈ ਕਿਰਪਾ ਕਰਕੇ ਮੈਨੂੰ ਇਹ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾਣ ਤਾਂ ਕਿ ਮੈਨੂੰ ਕੋਈ ਆਉਣ ਵਾਲੇ ਸਮੇਂ ਵਿੱਚ ਕੋਈ ਫਰਕ ਨਾ ਪਵੇ ਕੋਈ ਜਾਣਕਾਰੀ ਦੇ ਵਿੱਚ ਰੁਕਾਵਟ ਨਾ ਪਵੇ ਤੁਸੀਂ ਸਾਰੀ ਗੱਲਬਾਤ ਤੁਸੀਂ ਸਮਝਦੇ ਹੋ ਕਿ ਜਦੋਂ ਕਿਤੇ ਜਾਣਾ ਪੈਂਦਾ ਹੈ ਤਾਂ ਬੈਂਕ ਦੇ ਵਿੱਚ ਆਇਆ ਨੋਟਿਸ ਅੱਗੇ ਅੜਿੱਕਾ ਬਣ ਜਾਂਦਾ ਹੈ ਇਸ ਲਈ ਕੋਈ ਵੀ ਇਹ ਹੀ ਜਿਹੀ ਗੱਲਬਾਤ ਹੈ ਬੈਂਕ ਵਾਲਿਆਂ ਤੋਂ ਪਤਾ ਕਰਕੇ ਜਾਂ ਬੈਂਕ ਵਾਲੇ ਤੁਸੀਂ ਦੱਸੋ ਵੀ ਮੇਰੇ ਬਾ ਬਾਰੇ ਕੋਈ ਨੋਟਿਸ ਵਾਲੀ ਗੱਲ ਹੈ ਜਾਂ ਕੋਈ ਗਲਤ ਗੱਲ ਹੈ ਜਾਂ ਕੋਈ ਲੈਣ ਦੇਣ ਹੈ ਜਾਂ ਕੋਈ ਮੋਰੀ ਰਸੀਦ 'ਚ ਫਰਕ ਹੈ ਜਾਂ ਕੋਈ ਮੇਰੇ ਲੈਣ 'ਤੇ ਪੈਸਿਆਂ ਬਾਰੇ ਕੋਈ ਗੱਲਬਾਤ ਹੈ ਕੋਈ ਵੀ ਅਜਿਹੀ ਗੱਲ ਹੈ ਜਿਸ ਵਿੱਚ ਜਦੋਂ ਵੀ ਕੋਈ ਗੱਲ ਹੋਵੇ ਜਾਂ ਕਿਤੇ ਮੈਨੂੰ ਬੈਂਕ ਦੇ ਵਿੱਚ ਘੁਟਾਲੇ ਬਾਰੇ ਹੋਵੇ ਤਾਂ ਮੇਰਾ ਨਾਮ ਨਾ ਆਵੇ ਇਸ ਕਰਕੇ ਮੈਨੂੰ ਜਾਣਕਾਰ ਅਤੇ ਜਾਣਕਾਰੀ ਬਾਰੇ ਦੱਸੋ ਕਿ ਮੈਂ ਜੇ ਕਿਤੇ ਜਾਣਾ ਵੀ ਹੋਵੇ ਤਾਂ ਮੈਨੂੰ ਉਸ 'ਤੇ ਅੜਿੱਕਾ ਨਾ ਬਣੇ ਇਸ ਕਰਕੇ ਕਿਰਪਾ ਕਰਕੇ ਮੈਨੂੰ ਆਪਣੇ ਇਹ ਤਾਂ ਸਾਰੀਆਂ ਸਹੂਲਤਾਂ ਬਾਰੇ ਆਪਣੇ ਸਾਰੇ ਸਕੀਮਾਂ ਬਾਰੇ ਆ ਮੇਰੇ ਬਾਰੇ ਜੇ ਕੋਈ ਮੇਰੇ 'ਚ ਘਾਟ ਵਾਧ ਹੈ ਉਹ ਵੀ ਦੱਸੋ ਇਸ ਕਰਕੇ